ਸਾਡੇ ਪਿੰਡ ਦੇ ਪਰਿਵਾਰਾਂ ਦੇ ਝਗੜਿਆਂ ਦਾ ਹੱਲ ਦੋਨਾਂ ਧਿਰਾਂ ਦੇ ਕੁਝ ਮੋਹਤਵਰ ਬੰਦੇ ਆ ਮਿਲ ਕੇ ਉਹਨਾਂ ਦਾ ਹੱਲ ਕੱਢ ਲੈਂਦੇ ਹਨ ਅਤੇ ਮਾਮਲੇ ਨੂੰ ਸੁਲਝਾ ਲੈਂਦੇ ਹਨ ਅਤੇ ਜੇ ਝਗੜਾ ਜਾਂ ਮਸਲਾ ਕੋਈ ਜ਼ਿਆਦਾ ਹੀ ਪਹਿਚੀਦਾ ਹੋਵੇ ਤਾਂ ਪਿੰਡ ਦੀ ਪੰਚਾਇਤ ਦੇ ਵਿੱਚ ਜਾ ਕੇ ਉਸਦਾ ਹੱਲ ਕੱਢ ਲੈਂਦੇ ਹਾਂ ਪਿੱਛੇ ਜਿਹੇ ਸਾਡੇ ਪਿੰਡ ਵਿੱਚ ਇਸੇ ਤਰ੍ਹਾਂ ਦਾ ਇੱਕ ਜ਼ਮੀਨੀ ਵਿਵਾਦ ਹੋਇਆ ਸੀ ਅਤੇ ਦੋਨਾਂ ਧਿਰਾਂ ਦੇ ਜਿਹੜੇ ਮੋਹਤਵਾਰ ਬੰਦੇ ਸਨ ਬਜ਼ੁਰਗ ਬੰਦੇ ਸਨ ਉਹਨਾਂ ਨੇ ਮਿਲ ਕੇ ਉਸ ਝਗੜੇ ਦਾ ਹੱਲ ਕੱਢਿਆ ਸੀ